ਮੈਂ ਪਹਿਲਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਨੂੰ ਮਨੋਰੰਜਨ ਦਾ ਸਾਧਨ ਹਰ ਕਿਸੇ ਨੂੰ ਮਨੋਰੰਜਨ ਦਾ ਸਾਧਨ ਚਾਹੀਦਾ ਹੁੰਦਾ ਹੈ ਅਤੇ ਸ਼ੁਰੂ ਤੋਂ ਹੀ ਬੱਚਾ ਜਦੋਂ ਛੋਟਾ ਹੁੰਦਾ ਉਹ ਤੋਂ ਮਨੋਰੰਜਨ ਲਈ ਉਹ ਕੋਈ ਨਾ ਕੋਈ ਗੇਮ ਖੇਡਦਾ ਹੈ ਫਿਰ ਉਹ ਤੋਂ ਬਾਅਦ ਉਹ ਕੁ ਜਦੋਂ ਵੱਡਾ ਹੁੰਦਾ ਹੈ ਫਿਰ ਗੀਤ ਸੁਣਦਾ ਅਤੇ ਫਿਰ ਵੱਡਾ ਹੋਣ ਤੋਂ ਬਾਅਦ ਅੱਗੇ ਉਹ ਫਿਲਮਾਂ ਦੇਖਦਾ ਹੈ ਹੁਣ ਫਿਲਮਾਂ ਪਹਿਲਾਂ ਪ੍ਰੇਰ ਪਹਿਲਾਂ ਫਿਲਮਾਂ ਬਹੁਤ ਚੰਗੀਆਂ ਅਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਜੋ ਹਰ ਕ ਹਰ ਪਰਿਵਾਰ ਇਕੱਠੇ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਸੀ ਬਟ ਹੁਣ ਫਿਲਮਾਂ ਬਹੁਤ ਹੀ ਜ਼ਿਆਦਾ ਘਟੀਆ ਜਿਸ ਵਿੱਚ ਕੋਈ ਪ੍ਰੇਰਨਾ ਕੋਈ ਪ੍ਰੇਰਨਾ ਨਹੀਂ ਦਿਖਲਾਈ ਦਿੱਤੀ ਜਾਂਦੀ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ ਇਹ ਹੁਣ ਦੀਆਂ ਫਿਲਮਾਂ ਵਿੱਚ ਬਹੁਤ ਹੀ ਜ਼ਿਆਦਾ ਗੰਦਾਪਣ ਬਹੁਤ ਜ਼ਿਆਦਾ ਵੀ ਕਿਵੇਂ ਅਸੀਂ ਕਰਾਈਮ ਕਰਨਾ ਕਿਵੇਂ ਅਸੀਂ ਜੁਰਮ ਕਰਾਂਗੇ ਕਿਵੇਂ ਅਸੀਂ ਬਚਾਂਗੇ ਕਿਵੇਂ ਚੋਰੀ ਕਰਾਂਗੇ ਬਹੁਤ ਜ਼ਿਆਦਾ ਘਟੀਆ ਕਿਸਮ ਦੀਆਂ ਫਿਲਮਾਂ ਦਿਖਾਉਣ ਲੱਗ ਗਏ ਅਤੇ ਇਸ ਵਿੱਚ ਬਹੁਤ ਪਹਿਲਾਂ ਵਾਲੇ ਫਿਲਮਾਂ ਵਿੱਚ

ਪ੍ਰੇਰਨਾ ਨਹੀਂ ਦਿੰਦੀਆਂ ਸਗੋਂ ਬਹੁਤ ਜ਼ਿਆਦਾ ਹੀ ਬਕਵਾਸ ਮਤਲਬ ਉਹ ਉਹਨਾਂ ਲਈ ਗਲਤ ਗਲਤ ਨਜ਼ਰਾਂ ਨਾਲ ਹਰ ਕਿਸੇ ਨੂੰ ਦੇਖਣਾ ਅਤੇ ਗਲਤ ਸਿੱਖਿਆ ਦੇ ਰਹੀਆਂ ਨੇ ਇਸ ਲਈ ਫਿਲਮਾਂ ਅ ਪ ਪੁਰਾਣੇ ਜ਼ਮਾਨੇ ਦੀਆਂ ਫਿਲਮਾਂ ਬਹੁਤ ਵਧੀਆ ਸੀ ਅਤੇ ਪਹਿਲਾਂ ਸਾਡੇ ਕੋਲ ਰੰਗੀਨ ਟੀ ਵੀ ਹੁੰਦਾ ਸੀ ਅਤੇ ਫਿਲਮਾਂ ਬਹੁਤ ਥੋ ਵੱਡੀਆਂ ਹੁੰਦੀਆਂ ਸੀ ਹੁਣ ਫਿਲਮਾਂ ਬਹੁਤ ਛੋਟੀਆਂ ਕਰਤੀਆਂ ਅਤੇ ਹੁਣ ਹੌਲੀ ਹੌਲੀ ਟੀ ਵੀ ਵਿੱਚ ਵੀ ਫ਼ਰਕ ਆਇਆ ਹੁਣ ਟੀ ਵੀ ਬਹੁਤ ਹੁਣ ਐਲ ਸੀ ਡੀ ਹੋ ਗਈ ਇਸ ਲਈ ਸਾਨੂੰ ਹੱਦ ਤੋਂ ਵੱਧ ਫਿਲਮਾਂ ਪਹਿਲਾਂ ਵਾਲੀਆਂ ਦੇਖਣੀਆਂ ਚਾਹੀਦੀਆਂ ਸੀ ਹੁਣ ਫਿਲਮਾਂ 'ਚ ਕੋਈ ਵੀ ਦਮ ਨਹੀਂ ਰਿਹਾ ਅਤੇ ਮੈਨੂੰ ਮੈਂ ਫਿਲਮ ਜੋ ਕੁਝ ਫਿਲਮ ਹਜੇ ਵੀ ਹੈ ਜੋ ਵਧੀਆ ਹੈ ਵਧੀਆ ਕੱਪੜੇ ਪਾਉਂਦੀਆਂ ਹਨ ਅਤੇ ਵਧੀਆ ਪ੍ਰੇਰਨਾ ਦਿੰਦੀਆਂ ਨੇ ਜਿਵੇਂ ਚੱਕਦੇ ਇੰਡੀਆ ਚਾਰ ਸਾਹਿਬਜ਼ਾਦੇ ਆ ਆਦਿ ਫਿਲਮਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ ਅਤੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੀ ਮੈਂ ਇਹਨਾਂ ਦੀ ਪ੍ਰੇਰਨਾ 'ਤੇ ਚੱਲਣ ਦੀ